ਜਿਵੇਂ ਕਿ ਮੇਰੇ ਜ਼ਿਲ੍ਹੇ ਮੈਂ ਗੱਲ ਕਰਾਂ ਤਾਂ ਮੇਰਾ ਜ਼ਿਲ੍ਹਾ ਰੋਪੜ ਹੈ ਰੋਪੜ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਥਾਵਾਂ ਹੈ ਘੁੰਮਣ ਫਿਰਨ ਲਈ ਜਿਵੇਂ ਕਿ ਹੈੱਡ ਵਰਕਸ ਹੈ ਸਤਲੁਜ ਦਰਿਆ ਹੈ ਟਿੱਬੀ ਸਾਹਿਬ ਗੁਰਦੁਆਰਾ ਹੈ ਆਪਣਾ ਭੱਠਾ ਸਾਹਿਬ ਗੁਰਦੁਆਰਾ ਹੈ ਅਤੇ ਕੀਰਤਪੁਰ ਸਾਹਿਬ ਆ ਅਨੰਦਪੁਰ ਸਾਹਿਬ ਆ ਜਿੱਥੇ ਕਿ ਵਿਰਾਸਤ ਏ ਖਾਲਸਾ ਬਣਿਆ ਹੋਇਆ ਹੈ ਅਤੇ ਚਮਕੌਰ ਸਾਹਿਬ ਗੁਰਦੁਆਰੇ ਆ ਬਹੁਤ ਸੋਹਣੇ ਗੁਰਦੁਆਰੇ ਆ ਅਤੇ ਇਨ੍ਹਾਂ ਨੂੰ ਜਿਵੇਂ ਕਿ ਹੋਰ ਟੂਰੀਸ਼ਟ ਬਣਾਉਣ ਲਈ ਤਾਂ ਅਸੀਂ ਆਪਣੇ ਜ਼ਿਲ੍ਹੇ ਵਿੱਚ ਸ਼ੋਪਿੰਗ ਮੌਲ ਬਣਵਾ ਸਕਦੇ ਹਾਂ ਜਿਨ੍ਹਾਂ ਨਾਲ ਹੋਰ ਜ਼ਿਆਦਾ ਲੋਕ ਪ੍ਰਭਾਵਿਤ ਹੋ ਕੇ ਆਉਣ ਅਤੇ ਜਿਵੇਂ ਕਿ ਸਤਲੁਜ ਦਰਿਆ ਵਿੱਚ ਬੋਟਿੰਗ ਸ਼ੁਰੂ ਕਰ ਸਕਦੇ ਆ ਅਤੇ ਆਪਾਂ ਜੇ ਹੋਰ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਵਿੱਚ ਵਿਰਾਸਤ ਏ ਖਾਲਸਾ ਵਿੱਚ ਉੱਥੇ ਪਾਰਕਿੰਗ ਵਗੈਰਾ ਨੂੰ ਹੋਰ ਇੰਮਪਰੂਵਮੈਂਟ ਕਰ ਸਕਦੇ ਆ ਅਤੇ ਉੱਥੇ ਜੋ ਵੀ ਦਿੱਕਤ ਆਉਂਦੀ ਆ ਜਿਵੇਂ ਪਾਰਕ ਬੱਸ ਸਟੈਂਡ ਬਹੁਤ ਦੂਰ ਉੱਥੇ ਤੋਂ ਉੱਥੇ ਤੋਂ ਬੱਸਾਂ ਫ੍ਰੀ ਲਗਵਾ ਸਕਦੇ ਆ ਇਹ ਸਭ ਆਪਾਂ ਆਪਣੇ ਰੋਪੜ ਜ਼ਿਲ੍ਹੇ ਦੀ ਵਿੱਚ ਪੂਰਵ ਅਤੇ ਇਨ੍ਹਾਂ ਨੂੰ ਵ ਦੂਰ ਕਰ ਸਕਦੇ ਆ